ਪੰਜਾਬ ਵਿੱਚ ਵਪਾਰਿਕ ਖੇਤਰ ਅਤੇ ਉਦਯੋਗ ਇੱਕ ਦੂਜੇ ਨਾਲ ਕਈ ਤਰੀਕਿਆਂ ਨਾਲ ਜੁੜੇ ਹੋਏ ਹਨ ਇਹ ਸਿਰਫ ਸਮਾਨ ਦੀ ਲੈਣ ਦੇਣ ਸਮਾਨ ਦੀ ਲੈਣ ਦੇਣ ਨਹੀਂ ਇਹ ਇਨਫੋਰਮੇਸ਼ਨ ਇਨਫੋਰਮੇਸ਼ਨ ਅੰਤਰ ਖੇਤਰ ਅੰਤਰ ਅਨੁਸ਼ਾਸਨੀ ਐਕਟੀਕਰਨ ਨਾਲ ਵੀ ਇੱਕ ਦੂਜੇ ਨਾਲ ਜੁੜੇ ਹੋਏ ਹਨ ਇਹ ਇੱਕ ਦੂਜੇ ਨਾਲ ਕਈ ਤਰੀਕਿਆਂ ਨਾਲ ਇਨਫੋਰਮੇਸ਼ਨ ਅਦਲਾ ਬਦਲੀ ਕਰਦੇ ਹਨ ਅਤੇ ਇਸ ਰੂਪ ਵਿੱਚ ਇਹ ਬਹੁਤ ਹੀ ਬਹੁਤ ਹੀ ਤਰੱਕੀ ਨਾਲ ਕੰਮ ਕਰਦੇ ਹਨ ਨੈਟਵਰਕਿੰਗ ਅੰਤਰ ਖੇਤਰ ਦਾ ਮਤਲਬ ਇਹ ਨਹੀਂ ਕਿ ਇਹ ਇੱਕ ਦੂਜੇ ਨਾਲ ਜੁੜ ਕੇ ਆਪਣੇ ਕੰਮ ਨੂੰ ਵਧਾ ਨਹੀਂ ਸਕਦੇ ਇਹ ਇੱਕ ਦੂਜੇ ਨਾਲ ਜੁੜ ਕੇ ਆਪਣੇ ਕੰਮ ਨੂੰ ਹੋਰ ਵਧਾਉਂਦੇ ਹਨ ਅਤੇ ਇਸ ਨਾਲ ਪੰਜਾਬ ਵਿੱਚ ਬਹੁਤ ਫਾਇਦਾ ਹੁੰਦਾ ਹੈ ਪੰਜਾਬ ਵਿੱਚ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਆਪਾਂ ਖੇਤੀਬਾੜੀ ਖੇਡ ਵੀ ਖੇਡ ਖੂਡ ਵਿੱਚ ਅੱਗੇ ਵਧੀਏ ਅਤੇ ਇਸ ਲਈ ਪੰਜਾਬ ਵਿੱਚ ਇੱਕ ਜਲੰਧਰ ਵਿੱਚ ਇੱਕ ਖੇਡ ਇੰਡਸਟਰੀ ਹੈ ਅਤੇ ਲੁਧਿਆਣਾ ਵਿੱਚ ਟੈਕਸਟਾਈਲ ਇੰਡਸਟਰੀ ਵੀ ਹੈ ਇਹ ਇਹ ਇੱਕ ਦੂਜੇ ਨਾਲ ਅੰਤਰ ਅਨੁਸ਼ਾਸਨੀ ਨਾਲ ਵੀ ਇੱਕ ਦੂਜੇ ਨਾਲ ਜੁੜੇ ਹੋਏ ਹਨ ਕਿਉਂਕਿ ਇਹ ਜਦੋਂ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਇੱਕ ਦੂਜੇ ਬਾਰੇ ਲੈਣ ਦੇਣ ਕਰਦੇ ਹਨ ਤਾਂ ਏਗੀ ਇਨਫੋਰਮੇਸ਼ਨ ਸ਼ੇਅਰ ਕਰਦੇ ਹਨ ਤਾਂ ਇਸ ਨਾਲ ਬਹੁਤ ਵਾਧਾ ਹੁੰਦਾ ਹੈ ਅਤੇ ਇਹਨਾਂ ਦੀ ਬਹੁਤ ਤਰੱਕੀ ਹੁੰਦੀ ਹੈ ਇਸ ਨਾਲ ਪੰਜਾਬ ਵਿੱਚ ਵੀ ਬਹੁਤ ਫਾਇਦਾ ਹੁੰਦਾ ਹੈ ਬਿਜ਼ ਇਸ ਨਾਲ ਬਿਜ਼ਨਸ ਦਾ ਬਹੁਤ ਵਾਧਾ ਹੁੰਦਾ ਹੈ ਅਤੇ ਵਪਾਰਿਕ ਸ ਖੇਤਰ ਅਤੇ ਉਦਯੋਗਾਂ ਸੈਕਟਰਾਂ ਦਾ ਵੀ ਸਹਿਯੋਗ ਅਤੇ ਭਾਈਵਾਲੀ ਕਰਦਾ ਹੈ